ਅਤੇ ਪ੍ਰਸ਼ਨ ਕੁਝ ਇਸ ਪ੍ਰਕਾਰ ਹੈ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵਿਅਕਤੀ ਲਈ ਤੁਹਾਡੇ ਪਿੰਡ ਵਿੱਚ ਪ੍ਰਸਿੱਧ ਘਰੇਲੂ ਉਪਚਾਰ ਕੀ ਹਨ ਅਤੇ ਆਹ ਪ੍ਰਸ਼ਨ ਹੈ ਅਸੀਂ ਇਹਦੇ 'ਤੇ ਗੌਰ ਕਰਦੇ ਹੋਏ ਇਹਦਾ ਆਨਸਰ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਆਪਣਾ ਢਿੱਡ ਵਧਾਉਣਾ ਤੁਸੀਂ ਚੌਲ ਖਾਓ ਵੱਧ ਤੋਂ ਵੱਧ ਚੌਲ ਖਾਓ ਉਹਦੇ ਨਾਲ ਤੁਹਾਡਾ ਢਿੱਡ ਬਾਹਰ ਨਿਕਲੂਗਾ ਅਤੇ ਤੁਹਾਡਾ ਢਿੱਡ ਵੱਧ ਜਾਊਗਾ ਅਤੇ ਅਤੇ ਹੋਰ ਵੀ ਤੁਸੀਂ ਬਹੁਤ ਚੀਜ਼ਾਂ ਖਾ ਸਕਦੇ ਹੋ ਮਤਲਬ ਘਰ 'ਚ ਬਣੀ ਹਰ ਇੱਕ ਚੀਜ਼ ਦੁੱਧ ਮੱਖਣ ਮਲਾਈ ਦਹੀਂ ਰੋਟੀ ਸਬਜ਼ੀ ਸਭ ਕੁਝ ਖਾਓ ਕੋਈ ਵੀ ਚੀਜ਼ ਨਾਲ ਪਰਹੇਜ਼ ਨਾ ਕਰੋ ਸਭ ਕੁਝ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਫਾਸਟ ਫੂਡ ਖਾਓਗੇ ਤਾਂ ਹੀ ਤੁਹਾਡਾ ਢਿੱਡ ਵਧੂਗਾ ਤੁਸੀਂ ਘਰ ਦੀਆਂ ਚੀਜ਼ਾਂ ਨਾਲ ਵੀ ਆਪਣਾ ਢਿੱਡ ਵਧਾ ਸਕਦੇ ਹੋ ਬਹੁਤ ਸਾਰੀਆਂ ਅੱਜ ਕੱਲ੍ਹ ਨਾ ਐਕਸਰਸਾਈਜ਼ ਵੀ ਆ ਚੁੱਕੀ ਹੈ ਜਿਹਦੇ ਨਾਲ ਤੁਸੀਂ ਆਪਣਾ ਢਿੱਡ ਵਧਾ ਸਕਦੇ ਹੋ ਉਹ ਐਕਸਰਸਾਈਜ਼ ਤੁਸੀਂ ਕਰੋ ਅਤੇ ਘਰ 'ਚ ਵੀ ਬਣੀ ਹਰ ਇੱਕ ਚੀਜ਼ ਦਾ ਇਸਤੇਮਾਲ ਕਰੋ ਉਹਨਾਂ ਨੂੰ ਖਾਓ ਪੀਓ ਅਤੇ ਉਹਦੇ ਨਾਲ ਵੀ ਤੁਹਾਡਾ ਢਿੱਡ ਬਹੁਤ ਜ਼ਿਆਦਾ ਵੱਧ ਸਕਦਾ ਅਤੇ ਤੁਸੀਂ ਮਤਲਬ ਘੁੰਮੋ ਫਿਰੋ ਨਾ ਜ਼ਿਆਦਾ ਭਾਰ ਵਧਾਉਣ ਵਾਸਤੇ ਭਾਰ ਤੁਹਾਡਾ ਵੱਧ ਜਾਊਗਾ ਵਜਨ ਹੋ ਜਾਊਗਾ ਬਹੁਤ ਜ਼ਿਆਦਾ ਤੁਸੀਂ ਖਾਂਦੇ ਪੀਂਦੇ ਘਰਦੇ ਬੰਦੇ ਬਣੋ ਖਾਈ ਜਾਓ ਪੀ ਜਾਓ ਮਜ਼ੇ ਕਰੋ ਦੱਬ ਕੇ ਖਾਓ ਬਿਨਾਂ ਟੈਂਸ਼ਨ ਦੇ ਖਾਓ ਇੱਕ ਤਾਂ ਨਾ ਦੀ ਆਪਾਂ ਟੈਨਸ਼ਨ ਲਈਏ ਫਿਰ ਵੀ ਭਾਰ ਘੱਟ ਜਾਂਦਾ ਅਤੇ ਖਾਓ ਟੈਂਸ਼ਨ ਨਾ ਲਓ ਉਸ ਚੀਜ਼ ਦੀ ਬਸ ਦੱਬ ਕੇ ਖਾਂਦੇ ਰਹੋ ਪੀਂਦੇ ਰਹੋ ਮਜ਼ੇ ਕਰੋ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਹੈ ਬਸ ਖਾਂਦੇ ਰਹੋ ਅਤੇ ਦੁੱਧ ਮਲਾਈ ਮੱਖਣ ਘਿਓ ਮੈਂ ਤੇਰਾ ਪਿਓ